ਹਾਲ ਫਿਲਹਾਲ ਹੀ ਮੈਂ ਕੁਝ ਸਮੇਂ ਪਹਿਲਾਂ ਸਾਡੇ ਹੀ ਸ਼ਹਿਰ 'ਤੇ ਬੋਰਡਰ ਰੋਡ ਯਾਨੀ ਕਿ ਸੁਲੇਮਾਨਕੀ ਬਾਰਡਰ ਦੀ ਤਰਫ ਸਾਈਕਲ ਰਾਹੀਂ ਯਾਤਰਾ ਕੀਤੀ ਸੀ ਉਸ ਯਾਤਰਾ ਦੇ ਸਮੇਂ ਮੈਂ ਆਸਫ ਅਲਵਾਰ ਮੈਮੋਰੀਅਲ ਵੇਖਿਆ ਜਿੱਥੇ ਸਾਡੇ ਸ਼ਹੀਦਾਂ ਬਾਰੇ ਉੱਥੇ ਜਾਣਕਾਰੀ ਦਿੱਤੀ ਹੋਈ ਸੀ ਉੱਥੇ ਉਹਨਾਂ ਦੇ ਨਾਮ ਲਿਖੇ ਹੋਏ ਸੀ ਅਤੇ ਤਸਵੀਰਾਂ ਲੱਗੀਆਂ ਹੋਈਆਂ ਸੀ ਉਸ ਨੂੰ ਵੇਖ ਕੇ ਮੈਨੂੰ ਬਹੁਤ ਹੀ ਦੁੱਖ ਹੋਇਆ ਅਤੇ ਪ੍ਰਾਊਡ ਵੀ ਫੀਲ ਹੋਇਆ ਕਿ ਸਾਡੇ ਲੋਕਾਂ ਲਈ ਉਹਨਾਂ ਨੇ ਇੰਨੀਆਂ ਸ਼ਹੀਦੀਆਂ ਦਿੱਤੀਆਂ ਅਤੇ ਉਸ ਤੋਂ ਬਾਅਦ ਮੈਂ ਸਾਡੇ ਸੁਲੇਮਾਨਕੀ ਬਾਰਡਰ ਜੋ ਕਿ ਇੰਡੀਆ ਅਤੇ ਪਾਕਿਸਤਾਨ ਦਾ ਬਾਰਡਰ ਹੈ ਉਥੇ ਸਾਈਕਲ ਰਾਹੀਂ ਹੀ ਮੈਂ ਪੂਰਾ ਯਾਤਰਾ ਕੀਤੀ ਉੱਥੇ ਜਾ ਕੇ ਮੈਂ ਵੇਖਿਆ ਕਿ ਉੱਥੇ ਸ਼ਾਮ ਨੂੰ ਪਰੇਡ ਹੁੰਦੀ ਹੈ ਅਤੇ ਸਾਡੇ ਦੇਸ਼ ਦੇ ਨੌਜਵਾਨ ਬਹੁਤ ਹੀ ਜੋਸ਼ ਨਾਲ ਉਸ ਪਰੇਡ ਨੂੰ ਕਰਦੇ ਹਨ ਉਹਨਾਂ ਨੂੰ ਵੇਖ ਕੇ ਮੈਨੂੰ ਇੱਕ ਬਹੁਤ ਹੀ ਪ੍ਰਾਊਡ ਅਤੇ ਮੈਨੂੰ ਅੱਛਾ ਫੀਲ ਹੋਇਆ ਕਿ ਸਾਡੇ ਦੇਸ਼ ਦੇ ਵਿੱਚ ਇਸ ਚੀਜ਼ ਨੂੰ ਇਹਨਾਂ ਸੀਰੀਅਸ ਲਿੱਤਾ ਜਾਂਦਾ ਅਤੇ ਮੈਂ ਵੇਖਿਆ ਕਿ ਉੱਥੇ ਮੇਰੇ ਇਲਾਵਾ ਬਹੁਤ ਸਾਰੇ ਲੋਕ ਸਾਈਕਲ ਰਾਹੀਂ ਹੀ ਉੱਥੇ ਯਾਤਰਾ ਕਰਕੇ ਆਏ ਸੀ ਅਤੇ ਇਹ ਮੇਰੇ ਖਿਆਲ ਤੋਂ ਬਹੁਤ ਹੀ ਜ਼ਰੂਰੀ ਹੈਗੀ ਸਾਨੂੰ ਅੱਜ ਦੇ ਸਮੇਂ ਅੰਦਰ ਸਾਈਕਲ ਦੀ ਵਰਤੋਂ ਕਰਕੇ ਯਾਤਰਾ ਜਾਂ ਸ਼ਹਿਰ ਦੇ ਅੰਦਰ ਘੁੰਮਣਾ ਚਾਹੀਦਾ ਹੈ ਇਸ ਕਰਕੇ ਸਾਡੇ ਸ਼ ਸ਼ਰੀਰ ਦੀ ਸਿਹਤ ਬਣੀ ਰਹਿੰਦੀ ਹੈ ਅਤੇ ਸਾਡਾ ਮਾਨਸਿਕ ਸੰਤੁਲਨ ਵੀ ਸਹੀ ਰਹਿੰਦਾ ਹੈ ਅਤੇ ਆਉਣ ਵਾਲੇ ਸਮੇਂ ਅੰਦਰ ਮੈਂ ਦੁਬਾਰਾ ਸਾਡੇ ਸ਼ਹਿਰ ਦੇ ਉਸ ਬੋਡਰ 'ਤੇ ਜਾਵਾਂਗਾ ਅਤੇ ਮੈਨੂੰ ਬਹੁਤ ਹੀ ਅੱਛਾ ਲੱਗਦਾ ਵੇਖਦੇ ਕਿ ਮੇਰੇ ਇਲਾਵਾ ਵੀ ਬਹੁਤ ਲੋਕ ਆ ਰਹੇ ਹਨ ਧੰਨਵਾਦ